ਸਤਿ ਸ਼੍ਰੀ ਅਕਾਲ ਜੀ ਜੇ ਲੋਕਡਾਊਨ ਦਾ ਦੱਸਿਆ ਜਾਏ ਤਾਂ ਲੋਕਡਾਊਨ ਜਿਹੜਾ ਹੈਗਾ ਆ ਉਹਨੇ ਸਾਡਾ ਦਿਨ ਚਰਿਆ ਜਾਂ ਫਿਰ ਸਾਡੀ ਜ਼ਿੰਦਗੀ 'ਚ ਬਹੁਤ ਬਦਲਾਅ ਲਿਆਉਂਦੇ ਆ ਇੱਕ ਤਾਂ ਸਾਡਾ ਜਿਹੜਾ ਆ ਫੋਨ ਦਾ ਇਸਤੇਮਾਲ ਜਿਹੜਾ ਉਹ ਬਹੁਤ ਜ਼ਿਆਦਾ ਵਧਾ ਤਾ ਆ ਅਸੀਂ ਲੋਕ ਫੋਨ 'ਤੇ ਬਹੁਤ ਨਿਰਭਰ ਹੋ ਗਏ ਹਾਂ ਹੁਣ ਤਾਂ ਸਾਰਾ ਕੰਮ ਵੀ ਫੋਨ 'ਤੇ ਹੋ ਗਿਆ ਆ ਕਿਉਂਕਿ ਜਦੋਂ ਲੋਕਡਾਊਨ ਨਹੀਂ ਸੀਗਾ ਉਦੋਂ ਫਿਰ ਵੀ ਕਿਸੇ ਹੱਦ ਤੱਕ ਬੱਚੇ ਜਿਹੜੇ ਸੀਗੇ ਉਹ ਫੋਨ ਘੱਟ ਯੂਜ਼ ਕਰਦੇ ਸੀ ਇਸਤੇਮਾਲ ਘੱਟ ਕਰਦੇ ਸੀਗੇ ਕਿਉਂਕਿ ਸਕੂਲ ਕਾਲਜਾਂ 'ਚ ਜਾਂਦੇ ਸੀਗੇ ਤਾਂ ਫੋਨ ਉੱਥੇ ਫੋਨ ਘਰ ਤਾਂ ਕੀ ਵਰਤਣਾ ਅਤੇ ਇੱਕ ਸਕੂਲ 'ਚ ਵੀ ਨਹੀਂ ਸੀ ਅ ਵਰਤਣ ਦਿੰਦੇ ਹੁਣ ਤਾਂ ਇੱਦਾਂ ਦਾ ਹੋ ਗਿਆ ਲੋਕਡਾਊਨ ਤੋਂ ਬਾਅਦ ਕਿ ਕਲਾਸਿਸ ਕੋਈ ਵੀ ਛੁੱਟੀ ਹੋ ਜਾਵੇ ਕੁਛ ਵੀ ਹੋ ਜਾਵੇ ਹੁਣ ਤਾਂ ਬੱਚਿਆਂ ਦੀ ਬਸ ਕਲਾਸਿਸ ਔਨਲਾਈਨ ਲਗਾ ਦਿੰਦੇ ਆ ਇੱਕ ਇਹਦਾ ਦੋ ਪਹਿਲੂ ਹੁੰਦੇ ਆ ਹਰ ਇੱਕ ਚੀਜ਼ ਦੇ ਇਹਦਾ ਮਤਲਬ ਇੱਕ ਵਧੀਆ ਵੀ ਹੈਗਾ ਤਾਂ ਨੈਗੇਟਿਵ ਵੀ ਹੈਗਾ ਆ ਕਿ ਜੇ ਬੱਚੇ ਜ਼ਿਆਦਾ ਫੋਨ ਯੂਜ਼ ਕਰਨਗੇ ਤਾਂ ਉਹਨਾਂ ਦੀ ਜਿਹੜੀਆਂ ਅੱਖਾਂ ਆ ਉਹਨਾਂ ਦਾ ਜਿਹੜਾ ਦਿਮਾਗ ਆ ਉਹ ਜ਼ਿਆਦਾ ਯੂਜ਼ ਹੋਊਗਾ ਗਲਤ ਤਰੀਕੇ 'ਚ ਯੂਜ਼ ਹੋਊਗਾ ਹੁਣ ਫੋਨ ਇਕੱਲਾ ਵਧੀਆ ਤਾਂ ਚੀਜ਼ਾਂ ਲਈ ਹੈਗਾ ਨਹੀਂ ਉਹਦੇ ਚ ਨੈਗੇਟਿਵ ਚੀਜ਼ਾਂ ਵੀ ਹੁੰਦੀਆਂ ਆ ਬੁਰੀਆਂ ਚੀਜ਼ਾਂ ਵੀ ਹੁੰਦੀਆਂ ਆ ਇਸ ਕਰਕੇ ਬੱਚਿਆਂ ਲਈ ਮੈਂ ਕਹਿੰਦੀ ਹਾਂ ਕਿ ਫੋਨ ਜਿਹੜਾ ਆ ਲੋਕਡਾਊਨ ਨੇ ਬੱਚੇ ਜ਼ਿਆਦਾ ਖ਼ਰਾਬ ਕੀਤੇ ਆ ਬਟ ਹਾਂ ਜਿਹੜਾ ਅਸੀਂ ਕਹਿੰਦੇ ਹਾਂ ਵਰਕ ਫਰੋਮ ਹੋਮ ਆ ਉਹ ਉਹ ਵਧੀਆ ਰਿਹਾ ਆ ਕਿ ਜਿਹੜੇ ਲੋਕ ਜਿਹੜੇ ਲੋਕ ਸੀਗੇ ਕਿ ਹਾਂ ਕੰਮ ਛੁੱਟ ਜਾਣੇ ਆ ਉਹਨਾਂ ਦੇ ਕੰਮ ਛੁੱਟੇ ਨਹੀਂ ਔਨਲਾਈਨ ਕੰਮ ਚਲਦੇ ਰਹੇ ਵਧੀਆ ਚਲਦੇ ਰਹੇ ਜਿਹੜੇ ਕਾਰਪਰੇਟ 'ਚ ਜਿਹੜੇ ਵੀ ਸੀਗੇ ਉਹਨਾਂ ਨੇ ਸਾਰਿਆਂ ਨੇ ਆਪਣੇ ਕੰਮ ਘਰ ਤੋਂ ਹੀ ਕੀਤੇ ਆਪਣੀਆਂ ਸੈਲਰੀਆਂ ਪਾਈਆਂ ਸਭ ਕੁਝ ਵਧੀਆ ਰਿਹਾ ਨਹੀਂ ਤਾਂ ਸਾਰਿਆਂ ਨੇ ਘਰ ਵਿਹਲੇ ਬਹਿ ਜਾਣਾ ਸੀਗਾ ਰੋਟੀ ਦਾ ਵੀ ਔਖਾ ਹੋ ਜਾਣਾ ਸੀਗਾ ਅਤੇ ਇਸ ਕਰਕੇ ਲੋਕਡਾਊਨ 'ਚ ਜਿਹੜਾ ਜੇ ਤੁਸੀਂ ਅਸ ਤੁਸੀਂ ਪੁੱਛਦੇ ਹਾਂ ਕਿ ਫੋਨ ਜਾਂ ਟੈਲੀਫੋਨ ਜਾਂ ਲੈਪਟਾਪ ਯੂਜ਼ ਦਾ ਸੀਗਾ ਬੱਚਿਆਂ ਲਈ ਮੈਂ ਮੰਨਦੀ ਹਾਂ ਉਹ ਸਕੂਲ ਉਦੋਂ ਤੱਕ ਜਿਹੜੇ ਸਕੂਲ ਲੱਗੇ ਸੀਗੇ ਉਹ ਤਾਂ ਚਲੋ ਮਜਬੂਰੀ 'ਚ ਲੱਗੇ ਸੀਗੇ ਬਟ ਹੁਣ ਜਿਹੜਾ ਕਰ ਰਹੇ ਹਾਂ ਬੁੱਕਾਂ ਵੀ ਔਨਲਾਈਨ ਕਰਤੀਆਂ ਆ ਸਭ ਕੁਛ ਔਨਲਾਈਨ ਕਰਤਾ ਆ ਕਲਾਸਿਸ ਵੀ ਔਨਲਾਈਨ ਕਰਤੀਆ ਉਹਦੇ ਇੰਪੈਕਟ ਨਾਲ ਹੀ ਕੀਤਾ ਆ ਠੀਕ ਹੈ ਅਤੇ ਉਹ ਮੇਰੇ ਹਿਸਾਬ ਨਾਲ ਉਹ ਸਹੀ ਨਹੀਂ ਹੈਗਾ ਕਿਉਂਕਿ ਜੇ ਬੱਚੇ ਸਾਰਾ ਦਿਨ ਹੀ ਫੋਨ ਚਾਹੇ ਉਹ ਪੜ੍ਹਨ ਲਈ ਹੀ ਯੂਜ਼ ਕਰ ਰਹੇ ਆ ਸਾਰਾ ਦਿਨ ਹੀ ਫੋਨ ਯੂਜ਼ ਕਰੀ ਜਾਣਗੇ ਫੋਨ ਚਲਾਈ ਜਾਣਗੇ ਕੋਈ ਉਹਨਾਂ ਦੇ ਸਿਰ 'ਤੇ ਤਾਂ ਬਹਿ ਨਹੀਂ ਸਕਦਾ ਕਿ ਹਾਂ ਜੇ ਬੱਚੇ ਦ ਤਿੰਨ ਘੰਟੇ ਹੈਗੇ ਆ ਅਤੇ ਤਿੰਨ ਘੰਟੇ ਫੋਨ ਚਲਾ ਰਹੇ ਅਤੇ ਤਿੰਨ ਘੰਟੇ ਕੋਈ ਦੇਖੂਗਾ ਇੱਦਾਂ ਤਾਂ ਹੋ ਨਹੀਂ ਸਕਦਾ ਅਤੇ ਇਸ ਕਰਕੇ ਬੱਚੇ ਉਹਨੂੰ ਨੈਗੇਟਿਵ ਤਰੀਕੇ ਨਾਲ ਵੀ ਯੂਜ਼ ਕਰਦੇ ਆ ਸੋ ਆਹੀ ਆ ਕਿ ਜਿਹੜਾ ਫੋਨ ਸੀਗਾ ਬੱਚਿਆਂ ਲਈ ਤਾਂ ਫਿਫਟੀ ਪ੍ਰਸੈਂਟ ਠੀਕ ਸੀਗਾ ਬਟ ਹਾਂ ਯੂਥ ਲਈ ਜਿਹੜੇ ਘਰ ਤੋਂ ਕੰਮ ਕਰ ਰਹੇ ਸੀਗੇ ਉਹਨਾਂ ਲਈ ਬਹੁਤ ਵਧੀਆ ਰਿਹਾ